ਸਕੂਲ ਇੱਕ ਅਜਿਹੀ ਸੰਸਥਾ ਹੈ ਜੋ ਕਿ ਵਿਦਿਆਰਥੀਆਂ ਦੀ ਸਿੱਖਿਆ ਲਈ ਸਿਖਲਾਈ ਜਾਣ ਵਾਲੀ ਥਾਂ ਹੁੰਦੀ ਹੈ ਮੈਂ ਸੋਚਦੀ ਹਾਂ ਕਿ ਸਿੱਖਿਆ ਦੀ ਘਾਟ ਕਾਰਨ ਸ਼ਹਿਰ ਦੇ ਮੁਕਾਬਲੇ ਪੇਂਡੂ ਖੇਤਰਾਂ ਦੇ ਲੋਕ ਦੀ ਆਵਾਜ਼ ਨੂੰ ਘੱਟ ਪਛਾਣਿਆ ਜਾਂਦਾ ਹੈ ਸ਼ਹਿਰਾਂ ਵਿੱਚ ਪ੍ਰਾਈਮਰੀ ਸਕੂਲ ਸਕੈਡਰੀ ਸਕੂਲ ਹੁੰਦੇ ਹਨ ਅਜਿਹੀਆਂ ਸੰਸਥਾ ਵਿੱਚ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਅੱਗੇ ਪੜ੍ਹ ਲਿਖ ਜਾਂਦੇ ਹਨ ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਦੇ ਵਿੱਚ ਕਾਲਜ ਯੂਨੀਵਰਸਿਟੀ ਵੀ ਹੁੰਦੀਆਂ ਹਨ ਜਿੱਥੇ ਕਿ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਾਰਡਨ ਵੈਲੀ ਅਤੇ ਪ੍ਰੀ ਸਕੂਲ ਵਰਗੇ ਵੀ ਸਕੂਲ ਹੁੰਦੇ ਹਨ ਛ ਜਿੱਥੇ ਕਿ ਛੋਟੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਪੇਂਡੂ ਖੇਤਰ ਵਿੱਚ ਇਹੋ ਜਿਹੇ ਸਕੂਲ ਵੀ ਖੋਲ੍ਹੇ ਜਾਣੇ ਚਾਹੀਦੇ ਹਨ ਪੇਂਡੂ ਖੇਤਰਾਂ ਵਿੱਚ ਅ ਪ੍ਰਾਈਮਰੀ ਸਕੂਲ ਸੈਕੰਡਰੀ ਸਕੂਲ ਵੀ ਖੋਲ੍ਹੇ ਜਾਣੇ ਚਾਹੀਦੇ ਹਨ ਸਰਕਾਰੀ ਸਕੂਲਾਂ ਦੇ ਮੁਕਾਬਲੇ ਪੇਂਡੂ ਖੇਤਰ ਵਿੱਚ ਕੋਲਜ ਯੂਨੀਵਰਸਿਟੀਆਂ ਵੀ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਪੇਂਡੂ ਖੇਤਰ ਦੇ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਅੱਗੇ ਵੱਧ ਸਕਣ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਸਰਕਾਰੀ ਸਕੂਲ ਹੀ ਹੁੰਦੇ ਹਨ ਜਿਨ੍ਹਾਂ ਵਿੱਚ ਵੀ ਅਧਿਆਪਕ ਚੰਗੀ ਤਰਾਂ ਅ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਪਾਉਂਦੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਲਈ ਕਾਫੀ ਵਧੇਰਾ ਕੁਛ ਮਿਲ ਜਾਂਦਾ ਹੈ ਮੈਂ ਸੋਚਦੀ ਹਾਂ ਕਿ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਵੀ ਇਸ ਸ਼ ਸ਼ਹਿਰਾਂ ਵਿੱਚ ਵੀ ਵੀ ਪੇਂ ਪੇਂਡੂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਆਉਣਾ ਚਾਹੀਦਾ ਹੈ ਪਰ ਅੱਜ ਕੱਲ੍ਹ ਦੇ ਸਮਾਜ ਵਿੱਚ ਇਹ ਗੱਲਾਂ ਨੂੰ ਕਾਫੀ ਟਾਈਮ ਤੋਂ ਨਜਰ ਅੰਦਾਜ਼ ਕੀਤਾ ਜਾ ਰਿਹਾ ਹੈ